ਹੈਲੋ ਪੂਜਾ ਕੀ ਹਾਲ ਚਾਲ ਹੈ ਮੈਂ ਮੋਨੀਕਾ ਬੋਲ ਰਹੀ ਨਵਾਂਸ਼ਹਿਰ ਤੋਂ ਅਤੇ ਪੂਜਾ ਮੈਂ ਨਾ ਕੱਲ੍ਹ ਲੁਧਿਆਣਾ ਆਉਣਾ ਸੀ ਅਤੇ ਮੈਨੂੰ ਦੱਸਣਾ ਮੈਂ ਜਿਸ ਤਰ੍ਹਾਂ ਲੁਧਿਆਣੇ ਆ ਕੇ ਸ਼ੋਂਪਿੰਗ ਕਰਨੀ ਅਤੇ ਬਾਅਦ ਜਿੱਦਾਂ ਲੰਚ ਕਰਨਾ ਹੋਵੇ ਅਤੇ ਫਿਰ ਮੈਂ ਕਿਹੜਾ ਰੈਸਟੋਰੈਂਟ ਟਰਾਈ ਕਰਾਂ ਜਿੱਥੇ ਅੱਛਾ ਫੂਡ ਮਿਲਦਾ ਹੋਵੇ ਜਿੱਦਾਂ ਸ਼ਾਹੀ ਪਨੀਰ ਵਗੈਰਾ ਜਾਂ ਦਾਲ ਮੱਖਣੀ ਠੀਕ ਹੈ ਮੈਨੂੰ ਜ਼ਰੂਰ ਦੱਸਣਾ ਜਿੱਥੇ ਸਟਾਫ ਵੀ ਅੱਛਾ ਹੋਵੇ ਸਰਵਿਸ ਅੱਛੀ ਹੋਵੇ ਅਤੇ ਬਾਅਦ 'ਚ ਜੇ ਸਵੀਟ ਡਿਸ਼ ਖਾਣੀ ਹੋਵੇ ਅਤੇ ਉਹ ਵੀ ਅੱਛੀ ਮਤਲਬ ਕੁਆਲਿਟੀ ਵਾਲੀ ਮਿਲਦੀ ਹੋਵੇ ਜੇ ਮਤਲਬ ਆਈਸਕ੍ਰੀਮ ਜਾਂ ਰਸਮਲਾਈ ਖਾਣੀ ਹੋਵੇ ਤਾਂ ਮੈਂ ਜ਼ਰੂਰ ਦੱਸਣਾ ਕਿਹੜਾ ਰੈਸਟੋਰੈਂਟ ਅੱਛਾ ਹੈਗਾ ਅਤੇ ਮੈਨੂੰ ਇਹ ਵੀ ਜ਼ਰੂਰ ਕਲੀਅਰ ਕਰਿਓ ਕਿ ਉੱਥੇ ਪਾਰਕਿੰਗ ਦੀ ਫੈਸਿਲਿਟੀ ਹੈਗੀ ਉੱਥੇ ਜ਼ਿਆਦਾ ਰੱਸ਼ ਤਾਂ ਨਹੀਂ ਹੁੰਦਾ ਅਤੇ ਉੱਥੋਂ ਦਾ ਉਹ ਸਰਵਿਸ ਕਿੱਦਾਂ ਦੀ ਹੈਗੀ ਇਹ ਜ਼ਰੂਰ ਮੈਨੂੰ ਦੱਸਿਓ ਅਤੇ ਇਹਦੇ ਲਈ ਚਾਹੇ ਤੂੰ ਅਗਰ ਬਿਜ਼ੀ ਹੈ ਅਤੇ ਮੈਨੂੰ ਚਾਹੇ ਵੱਟਸਐਪ 'ਤੇ ਮੈਸੇਜ ਭੇਜ ਦੀ ਅਗਰ ਫਰੀ ਤਾਂ ਮੈਨੂੰ ਕੋਲ ਕਰਦੀ ਅਤੇ ਦੂਸਰਾ ਮੈਂ ਟ੍ਰਾਈ ਕਰਾਂਗੀ ਕਿ ਜੇ ਫਰੀ ਹੋਊਗੇ ਜਲਦੀ ਲੁਧਿਆਣੇ ਤੋਂ ਸ਼ੋਪਿੰਗ ਕਰਕੇ ਮੈਂ ਤੈਨੂੰ ਫਿਰ ਮਿਲ ਕੇ ਵੀ ਜਾਵਾਂਗੀ